ਸਾਡੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਿੱਖਿਆ ਸਿਹਤ ਦੀ ਦੇਖ ਰੇਖ ਗਰੀਬੀ ਘਟਾਉਣ ਔਰਤਾਂ ਦਾ ਸਸ਼ਕਤੀਕਰਨ ਜਿਹੇ ਮੁੱਖ ਸਮਾਜ ਭਲਾਈ ਅਤੇ ਵਿਕਾਸ ਪ੍ਰੋਗਰਾਮ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਗਰੀਬਾਂ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਕੇ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰ ਕੇ ਗਰੀਬੀ ਘਟਾਈ ਜਾਂਦੀ ਹੈ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸੰਬੰਧੀ ਮੁਫਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਵਿਦਿਆਰਥੀਆਂ ਨੂੰ ਸਕੋਲਰਸ਼ਿਪ ਦੇ ਆਧਾਰ 'ਤੇ ਸਿੱਖਿਆ ਕੇਂਦਰ ਵਿੱਚ ਅਗਵ ਅੱਗੇ ਵਧਣ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਮੁਫਤ ਚੈਕਅਪ ਓਪਰੇਸ਼ਨ ਅਤੇ ਦਵਾਈਆਂ ਦੇ ਕੈਂਪ ਲਾ ਕੇ ਸਿਹਤ ਦੇ ਖੇਤਰ ਵਿੱਚ ਵੀ ਸਮਾਜ ਦਾ ਸਹਿਯੋਗ ਕੀਤਾ ਜਾਂਦਾ ਹੈ ਇਸ ਪ੍ਰਕਾਰ ਦੀਆਂ ਕਈ ਸਕੀਮਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ ਓਲਡ ਏਜ ਹੋਮ ਮਾਈ ਭਾਗੋ ਵਿੱਦਿਆ ਸਕੀਮ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ